ਕੁਮਾਰ ਬੁੱਕ ਸ਼ੋਪ ਸੇ ਬਾਤ ਕਰ ਰਹੇ ਹੋ ਹਿੰਦੀ ਮੈਂ ਪੁੱਛ ਬੁੱਕਸ ਦਾ ਪਤਾ ਕਰਨਾ ਸੀ ਮੈਂ ਜਿੱਦਾਂ ਫਸਟ ਸਮੈਸਟਰ ਬੀ ਸੀ ਏ ਕਰ ਰਹੀ ਹਾਂ ਬਟ ਮੈਨੂੰ ਸੈਕਿੰਡ ਸਮੈਸਟਰ ਦੀ ਚਾਹੀਦੀਆਂ ਅਵੇਲੇਬਲ ਹੋਣਗੀਆਂ ਹਾਂਜੀ ਨਿਊ ਅਡੀਸ਼ਨ ਚਾਹੀਦਾ ਆ ਅਤੇ ਤੁਸੀਂ ਕਿੰਨਾ ਡਿਸਕਾਊਟ ਦਿਓਗੇ ਮੈਨੂੰ ਬਾਹਰ ਤਾਂ ਫਿਫਟੀਨ ਪ੍ਰਸੈਂਟ ਮਿਲਦਾ ਪਿਆ ਡਿਸਕਾਊਂਟ ਮੈਂ ਬੁੱਕਸ ਦੱਸ ਦਿੰਦੀ ਸਬਜੈਕਟਸ ਤੁਸੀਂ ਫੇਰ ਨੋਟ ਕਰ ਲਓ

ਫੰਡਾਮੈਂਟਲ ਔਫ ਕੰਪਿਊਟਰ ਪਾਈਥਨ ਪਾਈਥਨ ਅਡਵਾਂਸ ਪਾਈਥਨ ਸੀਪਲੱਸਪਲੱਸ ਇੰਗਲਿਸ਼ ਔਰ ਪੰਜਾਬੀ ਪਰ ਤੁਸੀਂ ਮੈਨੂੰ ਡਿਸਕਾਊਂਟ ਦੀ ਗੱਲ ਦੱਸੋ ਕਿੰਨਾ ਕੁ ਨਹੀਂ ਟਵੰਟੀ ਪ੍ਰਸੈਂਟ ਚਾਹੀਦਾ ਮੈਨੂੰ ਠੀਕ ਹੈ ਔਰ ਹਾਂਜੀ ਡਿਲੀਵਰੀ ਹੋ ਜਾਂਦੀ ਹੈ ਠੀਕ ਹੈ ਐਡਵੇ ਐਡਰੈਸ ਵੀ ਲਿਖ ਲਓ ਬੀ ਫਿਫਟੀਨ ਫਿਫਟੀ ਏਟ ਅਜੀਤ ਨਗਰ ਕਪੂਰਥਲਾ ਕਿੰਨਾ ਟਾਈਮ ਲੱਗਗਾ ਇਸ ਤੋਂ ਜਲਦੀ ਨਹੀਂ ਹੋ ਸਕਦਾ ਮੈਨੂੰ ਚਾਹੀਦੀਆਂ ਸੀ ਅਤੇ ਨਿਊ ਐਡੀਸ਼ਨ ਹੀ ਹੋਵੇ ਕਿੰਨੇ ਦਿਨ ਤੱਕ ਠੀਕ ਹੈ ਓਕੇ ਥੈਂਕ ਯੂ